ਕੀ ਹੈ ਸਾਨੂੰ ਮਤਲਬ ਆਪਣੀ ਭੈਣ ਧੀ ਜਾਂ ਦੋਸਤ ਨੂੰ ਕੀ ਆ ਸਿੱਖਿਆ ਦਾ ਇੱਕ ਪਰੋ ਪਰੋਪਰ ਮੋਕਾ ਦੇਣਾ ਚਾਹੀਦਾ ਹੈ ਜਿਵੇਂ ਕਿ ਆਪਾਂ ਪਹਿਲੇ ਵਾਲੇ ਸਮਿਆਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਪਹਿਲੇ ਵਾਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਔਰਤ ਨੂੰ ਬਹੁਤ ਪਿੱਛੇ ਰੱਖਿਆ ਜਾਂਦਾ ਸੀ ਕਿ ਉਹਨੂੰ ਉੱਭਰਨ ਦਿੱਤਾ ਹੀ ਨਹੀਂ ਜ ਗਿਆ ਤਾਂ ਇੰਨੇ ਲੰਬੇ ਸਮੇਂ ਤੋਂ ਕੀ ਹੈ ਔਰਤ ਕੀ ਹੈ ਇਹ ਜੂਝ ਰਹੀ ਹੈ ਜੇ ਮਤਲਬ ਜਿਹੜੇ ਪਹਿਲਾਂ ਵੀ ਜੋ ਸਿੱਖਿਆ ਪ੍ਰਾਪਤ ਕਰ ਲਈ ਉਹਨਾਂ ਨੇ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਕੀ ਆ ਅੱਗੇ ਵਧਾਇਆ ਹੈ ਇੱਕ ਔਰਤ ਕੀ ਹੈ ਆਪਣੇ ਘਰੋਂ ਮਤਲਬ ਇੱਕ ਘਰ ਤੋਂ ਦੂਜੇ ਜਾਂਦੇ ਆ ਤਾਂ ਓਬਐਸਲੀ ਉਹਨੂੰ ਨੌਲੇਜ ਮਤਲਬ ਹੋਣੀ ਚਾਹੀਦੀ ਹੈ ਕੀ ਉਹ ਕੀ ਹੈ ਅਗਲੇ ਘਰ ਜਾ ਕੇ ਇੱਕ ਪਰੋਪਰ ਵਧੀਆ ਢੰਗ ਨਾਲ਼ ਕੀ ਆ ਆਪਣੀ ਜ਼ਿੰਦਗੀ ਨੂੰ ਗੁਜ਼ਾਰੇ ਕਿਉਂਕਿ ਦੇਖੋ ਇੱਕ ਔਰਤ ਜਦੋਂ ਆਪਣੇ ਘਰ ਹੁੰਦੀ ਹੈ ਤਾਂ ਉੱਥੇ ਉਹਨੂੰ ਉਸ ਉਸ ਤਰ੍ਹਾਂ ਦੇ ਮਾਹੌਲ ਦਾ ਪਤਾ ਹੁੰਦਾ ਪਰ ਅਗਰ ਉਹ ਮਤਲਬ ਸਿੱਖਿਆ ਉਹਨੂੰ ਪਰੋਪਰ ਮਿਲੀ ਹੋਵੇਗੀ ਤਾਂ ਕੀ ਹੈ ਉਹ ਕੀ ਹੈ ਅੱਗੇ ਵੀ ਉਹਨੂੰ ਪੂਰੇ ਸਮਾਜ ਦਾ ਪਤਾ ਹੋਵੇਗਾ ਕਿਸ ਸਮਾਜ ਦੇ ਵਿੱਚ ਕਿੱਦਾਂ ਰਹਿਣਾ ਹੈ ਕਿੱਦਾਂ ਖਾਣਾ ਹੈ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਤਾਂ ਹਰੇਕ ਤਰ੍ਹਾਂ ਦੀ ਉਹਨੂੰ ਕੀ ਹੈ ਜਾਣਕਾਰੀ ਹੋਵੇਗੀ ਜਿਹੜੀ ਸਿੱਖਿਆ ਹੈਗੀ ਇੱਕ ਮਤਲਬ ਕਿ ਕਿਸੇ ਵੀ ਵਿਅਕਤੀ ਦੇ ਚਰਿੱਤਰ ਨੂੰ ਕੀ ਹੈ ਉਭਾਰਨ ਦੇ ਵਿੱਚ ਮਦਦ ਕਰਦੀ ਹੈ ਤਾਂ ਉਸੇ ਤਰ੍ਹਾਂ ਜਿਵੇਂ ਪਹਿਲਾਂ ਕੀ ਹੈ ਲੋਕ ਮਤਲਬ ਮੁੰਡੇ ਕੁੜੀਆਂ ਦੇ ਵਿੱਚ ਇੰਨਾਂ ਜ਼ਿਆਦਾ ਫ਼ਰਕ ਕਰਦੇ ਸੀ ਕਿ ਉਹਨਾਂ ਮਤਲਬ ਕਿ ਮ ਮੁੰਡਾ ਹੀ ਸਭ ਕੁਛ ਹੁੰਦਾ ਸੀ ਤਾਂ ਉਸ ਚੀਜ਼ ਨੂੰ ਮਤਲਬ ਰੀਕਵਰ ਹੋਣ ਦੇ ਵਿੱਚ ਟਾਈਮ ਤਾਂ ਲੱਗੇਗਾ ਹੀ ਜਿਹੜਾ ਟਾਈਮ ਦੇ ਨਾਲ਼ ਹਾਂ ਉਸ ਚੀ ਉਹ ਚੀਜ਼ ਨੂੰ ਕੀ ਹੈ ਰੀਕਵਰੀ ਬਹੁਤ ਜ਼ਿਆਦਾ ਮਤਲਬ ਉਹ ਤੇਜ਼ੀ ਨਾਲ਼ ਹੋ ਰਹੀ ਹੈ ਹੁਣ ਲੋਕ ਮੁੰਡੇ ਕੁੜੀਆਂ ਦੇ ਫ਼ਰਕ ਨੂੰ ਛੱਡ ਕੇ ਮਤਲਬ ਜ ਇਨਸਾਨ ਸਮਝਣ ਲੱਗ ਪਏ ਨੇ ਪਰ ਹਾਂ ਕੁਛ ਕੁ ਲੋਕ ਹਜੇ ਵੀ ਇਹੋ ਜਿਹੇ ਨੇ ਜਿਹੜੇ ਕਿ ਮੁੰਡੇ ਅਤੇ ਕੁੜੀਆਂ ਦੇ ਵਿੱਚ ਫ਼ਰਕ ਮਤਲਬ ਸਮਝਦੇ ਨੇ ਕਰਦੇ ਨੇ ਅਤੇ ਪਰ ਉਹ ਲੋਕਾਂ ਉਹਨਾਂ ਲੋਕਾਂ ਨੂੰ ਛੱਡ ਕੇ ਅਗਰ ਆਪਾਂ ਦ ਉਹਨਾਂ ਨੂੰ ਲੋਕਾਂ ਨੂੰ ਸਮਝਾਈਏ ਕਰੀੇਏ ਕਿ ਨਹੀਂ ਲੜਕੀਆਂ ਵੀ ਬਰਾਬਰ ਨੇ ਲੜਕਿਆਂ ਦੇ ਹੀ ਅਤੇ ਕੀ ਹੈ ਲੜਕੀਆਂ ਨੂੰ ਸਿੱਖਿਆ ਦੇਣੀ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ 'ਚ ਜਿੰਨਾਂ ਚਾਹੇ ਬ ਇੱਕ ਜਿਹੜੀ ਲੜਕੀ ਐ ਉਹ ਪੜ੍ਹ ਸਕਦੀ ਹੈ ਅਤੇ ਸਿੱਖਿਆ ਪ੍ਰਾਪਤ ਕਰ ਸਕਦੀ ਹੈ